ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਹਿਜਦੀਪ ਕੌਰ ਬੋਲ ਰਹੀ ਹਾਂ ਜੀ ਦਿੱਲੀ ਤੋਂ ਅਤੇ ਮੈਂ ਇੱਕ ਯੂਟਿਊਬਰ ਹਾਂ

ਹਾਂਜੀ ਤੁਸੀਂ ਤੁਸੀਂ ਕਿਹੜੇ ਵਿਭਾਗ ਤੋਂ ਬੋਲਦੇ ਰਹੇ ਮੈਂ ਇੱਥੇ ਸਰਕਾਰੀ ਵਿਭਾਗ ਦੇ ਇੱਥੋਂ ਦੇ ਪ੍ਰਵਾਸ ਜਿਹੜਾ ਫ ਫਤਿਹਗੜ੍ਹ ਸਾਹਿਬ ਦੇ ਅੰਦਰ ਪ੍ਰਵਾਸ ਦੇ ਜਿਹੜੇ ਰੇਟ ਹਨ ਕੈ ਮੈਂ ਸੁਣਿਆ ਸੀ ਕਿ ਕੈਨੇਡਾ ਜਿਹੜੀ ਜਾਂਦੀ ਆ ਪਾਪੂਲੇਸ਼ਨ ਮੈਂ ਉਹਨਾਂ ਬਾਰੇ ਜਾਣਨਾ ਚਾਹੁੰਦੀ ਸੀ ਕਿਉਂਕਿ ਮੈਂ ਇੱਕ ਡਾਕੂਮੈਂਟਰੀ ਬਣਾ ਰਹੀ ਹਾਂ ਪੰਜਾਬ ਪੰਜਾਬੀ ਪ੍ਰਵਾਸ ਬਾਰੇ ਅਤੇ ਠੀਕ ਹੈ ਜੀ ਕੀ ਤੁਸੀਂ ਹਾਂਜੀ ਕੀ ਤੁਸੀਂ ਮਤਲਬ ਕਹਿ ਸਕਦੇ ਹੋ ਕਿ ਜਿਹੜਾ ਪੰਜਾਬ ਦਾ ਵਿੱਦਿਅਕ ਢਾਂਚਾ ਕਿਉਂਕਿ ਉਹਦੇ ਵਿੱਚ ਵਿਗਾੜ ਆ ਗਿਆ ਅਤੇ ਉਹਦੇ ਕਰਕੇ ਬੱਚੇ ਬੱਚੇ ਸਕੋਲਰਸ਼ਿਪਾਂ ਲੈ ਕੇ ਉੱਚ ਵਿੱਦਿਆ ਹਾਸਲ ਕਰਨ ਦੀ ਜਗ੍ਹਾ ਇੱਕ ਬਾਹਰ ਆਪਣਾ ਭਵਿੱਖ ਉਹਦੀ ਉਹ ਉੱਦਾਂ ਬਣਾਉਣ ਦੀ ਜਗ੍ਹਾ ਸਿਰਫ ਉੱਥੇ ਜਾ ਕੇ ਕੋਈ ਵੀ ਕੰਮ ਕਰਕੇ ਵਸਣ ਦੀ ਕੋਸ਼ਿਸ਼ ਕਰਦੇ ਹਨ ਅਤੇ ਜਿਹੜੀ ਨਿਰਾਸ਼ਕੀ ਜੀ ਆ ਗਈ ਹੈ ਕੀ ਇਹ ਵੀ ਅਸੀਂ ਵਿੱਦਿਅਕ ਢਾਂਚੇ ਨੂੰ ਜ਼ਿੰਮੇਵਾਰ ਠਹਿਰਾ ਸਕਦੇ ਹਾਂ ਹਾਂਜੀ ਜ਼ਰੂਰ ਜੀ ਬਿਲਕੁਲ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ